ਹੈਲੋ ਨਮਸਕਾਰ ਵਿੱਕੀ ਬੁੱਕ ਸੈਂਟਰ ਤੋਂ ਬੋਲ ਰਹੇ ਜੀ ਤੁਸੀਂ ਹਾਂਜੀ ਮੈਨੂੰ ਨਾ ਜੀ ਇੱਕ ਤਾਂ ਬੀਐਡ ਵਾਸਤੇ ਬੁੱਕ ਚਾਹੀਦੀ ਸੀ ਹਾਂਜੀ ਮੇਰਾ ਸਮੈਸਟਰ ਫੋਰਥ ਸਮੈਸਟਰ ਹੈ ਜੀ ਹਾਂਜੀ ਹਾਂਜੀ ਅਤੇ ਆਪਣੇ ਕੋਲ ਬੁਕਸ ਮਤਲਬ ਮਿਲ ਜਾਣਗੀਆਂ ਸਾਰੀਆਂ ਲਗਭਗ ਹਾਂਜੀ ਜਿਵੇਂ ਮੈਨੂੰ ਜਿਵੇਂ ਸੀਡੀਪੀ ਦੀ ਇੱਕ ਚਾਹੀਦੀ ਹੈ ਸਰ ਸਾਈਕਲੋਜਿਸ ਮੇਰੇ ਕੋਲ ਜੀ ਜਿਵੇਂ ਮੈਥ ਸਾਇੰਸ ਹੈ ਪੈਰਾਲੋਜਿਓ ਆਫ ਮੈਥ ਅਤੇ ਸਾਇੰਸ ਦੀ ਚਾਹੀਦੀ ਹੈ ਹਾਂਜੀ ਹਾਂਜੀ ਉਹ ਬੁਕਸ ਹੀ ਚਾਹੀਦੀਆਂ ਹਾਂਜੀ ਹਾਂਜੀ ਹਾਂਜੀ ਉਹ ਵੀ ਚਾਹੀਦੀ ਹੈ ਹਾਂਜੀ ਸਤ ਹਾਂਜੀ ਸਾਰਾ ਚਾਹੀਦਾ ਜੀ

ਇੰਨਾਂ ਮਹਿੰਗਾ ਜੀ ਪਚਵੰਜਾ ਸੌ ਦਾ ਜੀ ਨਹੀਂ ਇੰਨਾਂ ਤਾਂ ਮਹਿੰਗਾ ਨਹੀਂ ਪਹਿਲਾਂ ਮੈਂ ਲੈ ਕੇ ਵੀ ਗਿਆ ਸੀ ਜਿਵੇਂ ਸੈਕਿੰਡ ਸਮੈਸਟਰ ਉਸ ਟਾਈਮ ਹੀ ਨਹੀਂ ਸੀ ਅੱਛਾ ਜੀ ਨਹੀਂ ਤਾਂ ਫਿਰ ਤੁਸੀਂ ਮੈਨੂੰ ਕੋਈ ਡਿਸਕਾਊਂਟ ਤਾਂ ਦਿਓ ਵੀ ਫਿਰ ਪਚਵੰਜਾ ਸੌ ਅਤੇ ਇੰਨਾਂ ਕੀ ਹੈ ਅੱਛਾ ਅਤੇ ਫਿਰ ਵੱਧ ਤੋਂ ਵੱਧ ਜੀ ਕੋਈ ਕਰੋ ਕਰੋ ਜੀ ਥੋੜ੍ਹਾ ਘੱਟ ਤਾਂ ਤੁਹਾਨੂੰ ਪਤਾ ਹੀ ਹੈ ਸਟੂਡੈਂਟ ਨੇ ਪੈਸੇ ਅਵੇਲੇਬਲ ਕਿੰਨੇ ਕੁ ਹੁੰਦੇ ਆ ਨਹੀਂ ਨਹੀਂ ਕੁਛ ਤਾਂ ਕਰੋ ਜੀ ਲੈਸ ਅੱਗੇ ਵੀ ਤੁਹਾਡੇ ਕੋਲ ਲੈ ਕੇ ਜਾਂਦੇ ਹਾਂ ਸਾਰੀ ਬੁਕਸ ਨਹੀਂ ਨਹੀਂ ਜੀ ਕਰੋ ਕੁਛ ਤਾਂ ਕਰੋ ਜੀ ਇੰਨਾਂ ਥੋੜ੍ਹਾ ਮਹਿੰਗੀ ਹੁੰਦੀਆਂ ਨੇ ਬੁੱਕਸ ਕੋਈ ਅਤੇ ਚਲੋ ਡਿਸਕਾਊਂਟ ਕਰੋ ਇੰਨੀ ਦੂਰੋਂ ਚੱਲ ਕੇ ਆਏ ਤੁਹਾਡੇ ਕੋਲ ਅੱਛਾ ਉਹਦਾ ਕੀ ਰੇਟ ਹੈ ਅੱਠ ਸੌ ਅੱਛਾ ਜੀ ਉਹ ਵੀ ਲੱਗੇਗਾ ਜੀ ਅੱਛਾ ਹੁਣ ਮੈਨੂੰ ਮਤਲਬ ਮੈਂ ਕਿੰਨੇ ਪੈਸੇ ਸੈਂਡ ਕਰਨੇ ਤੁਹਾਨੂੰ ਕਿੰਨੇ ਦੇਣੇ ਹੈ ਜੀ ਨਹੀਂ ਤਰਵੰਜਾ ਸੌ ਕਰੋ ਤੁਸੀਂ ਸੌ ਤਾਂ ਦੋ ਸੌ ਤਾਂ ਕਰੋ ਚਲੋ ਤੁਸੀਂ ਫਿਰ ਛੱਡੋ ਪਰਾਂ ਸਾਰੇ ਤੁਸੀਂ ਤਰਵੰਜਾ ਸੌ ਦੀ ਗੱਲ ਬੁੱਕ ਕਰੋ ਅਤੇ ਮੈਨੂੰ ਨਾ ਸੈਟ ਸਲੈਕਟ ਕਰੋ ਬੰਦ ਅਤੇ ਮੈਨੂੰ ਭੇਜੋ ਠੀਕ ਹੈ ਓਕੇ ਠੀਕ ਆ ਨਹੀਂ ਨਹੀਂ ਮੈਂ ਚਲੋ ਆਪ ਹੀ ਲੈ ਜਾ ਤੁਸੀਂ ਫਿਰ ਬੁੱਕ ਪੈਕ ਕਰਕੇ ਰੱਖੋ ਠੀਕ ਹੈ ਜੀ ਥੈਂਕ ਯੂ